ਦਸ ਅਗਸਤ ਦੋ ਹਜ਼ਾਰ ਪੰਜ ਬਾਰਾਂ ਜਨਵਰੀ ਦੋ ਹਜ਼ਾਰ ਇੱਕ ਪੰਜ ਸਪਤੰਬਰ ਦੋ ਹਜ਼ਾਰ ਨੱਬੇ ਸੌਲਾਂ ਮਈ ਦੋ ਹਜ਼ਾਰ ਛਿਆਨਵੇਂ ਪੰਜ ਅਪ੍ਰੈਲ ਦੋ ਹਜ਼ਾਰ ਵੀਹ